ਅਸੀਂ ਜਿਵੇਂ ਕਿ ਪੰਜਾਬੀ ਪਰਿਵਾਰ ਆਪਣੇ ਜਨਮਦਿਨ 'ਤੇ ਹੋਰ ਵਿਸ਼ੇਸ਼ ਮੌਕਿਆਂ ਨੂੰ ਬਹੁਤ ਉਤਸ਼ਾਹ ਅਤੇ ਜੀਵਨਤਿਤਾ ਨਾਲ ਮਨਾਉਂਦੇ ਹਨ ਮੇਰੇ ਘਰ ਮੈਂ ਸਭ ਤੋਂ ਵੱਡਾ ਹਾਂ ਅਤੇ ਸਾਡੇ ਘਰ ਕਿਤੇ ਕੁਛ ਪਰੰਪਰਾਵਾਂ ਹੈ ਜਿਵੇਂ ਕਿ ਆਪਣੇ ਕੋਈ ਵੀ ਖੁਸ਼ੀ ਦੇ ਮੌਕੇ 'ਤੇ ਜਿਵੇਂ ਆਪਣੇ ਜਨਮਦਿਨ 'ਤੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦੇ ਨੇ ਅਤੇ ਫੇਰ ਭੋਗ ਪਾਉਂਦੇ ਨੇ ਅਤੇ ਲੰਗਰ ਲਾਉਂਦੇ ਨੇ ਸਾਰੇ ਆਰੇ ਪਿਆਰੇ ਰਿਸ਼ਤੇਦਾਰਾਂ ਨੂੰ ਸੱਦ ਲੈਂਦੇ ਹਾਂ ਅਤੇ ਬੜੇ ਰੰਗ ਚਾਅ ਨਾਲ ਕੋਈ ਵੀ ਖੁਸ਼ੀ ਦਾ ਮੌਕਾ ਮਨਾਉਂਦੇ ਨੇ ਅਤੇ ਕਦੇ ਕਦੇ ਆਪਣੇ ਮਨਪਸੰਦ ਪਕਵਾਨਾਂ ਨਾਲ ਜਿਵੇਂ ਕਿ ਆਪਣਾ ਨਾਨ ਦਾਲ ਮੱਖਣੀ ਨਾਲ ਵੀ ਸਾਰ ਲੈਂਦੇ ਹਾਂ ਅਤੇ ਕੁਛ ਕੁ ਵਿਸ਼ੇਸ਼ ਮੌਕਿਆਂ 'ਚ ਅਸੀਂ ਖਾਣ ਪੀਣ ਅਤੇ ਵਈ ਆਪਣਾ ਜਿਵੇਂ ਲੋਹੜੀ ਹੋ ਗਿਆ ਅਤੇ ਇੱਥੇ ਆਪਾਂ ਵੀ ਆਪਣੇ ਖਾਣ ਪੀਣ ਨਾਲ ਭੰਗੜੇ ਨਾਲ ਬੜੇ ਰੰਗ ਚਾਅ ਨਾਲ ਆਪਣਾ ਮਨਾਉਂਦੇ ਹਾਂ